ਜਿਵੇਂ ਕਿ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਸਾਡੇ ਸਾਰੇ ਕਿਸਾਨ ਇਸ ਉੱਤੇ ਨਿਰਭਰ ਕਰਦੇ ਸਨ ਸਾਡੀ ਫਸਲ ਨੂੰ ਵੇਚਣ ਵਾਸਤੇ ਸਾਨੂੰ ਮੰਡੀਆਂ ਵਿੱਚ ਜਾਣਾ ਪੈਂਦਾ ਹੈ ਮੰਡੀਆਂ ਵਿੱਚ ਸਰਕਾਰ ਵੱਲੋਂ ਇਸ ਦਾ ਰੇਟ ਨਹੀਂ ਲੱਗਦਾ ਜਿਵੇਂ ਕਿ ਇੱਕ ਵਿਚੋਲੀਆ ਹੁੰਦਾ ਹੈ ਉਸ ਉੱਤੇ ਅਸੀਂ ਉਸ ਨੂੰ ਅਸੀਂ ਮੱਧ ਪੁਰਸ਼ ਵੀ ਕਹਿੰਦੇ ਹਾਂ ਇਸ ਵਿਚੋਲੀਏ ਸਾਡੀ ਫਸਲ ਦਾ ਰੇਟ ਘੱਟ ਲਗਾਉਂਦੇ ਹਨ ਜਿਸ ਕਾਰਨ ਸਾਡਾ ਕੋਈ ਫ਼ਾਇਦਾ ਨਹੀਂ ਹੁੰਦਾ ਸਾਡਾ ਫਸਲ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਇਸ ਲਈ ਸਾਡੀਆਂ ਫਸਲਾਂ ਦੇ ਰੇਟ ਫਿਕਸ ਕੀਤੇ ਜਾਵੇ ਅਤੇ ਮੱਧ ਪੁਰਸ਼ ਲੋਕਾਂ ਨੂੰ ਹਟਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਲਾਭ ਹੋ ਸਕੇ ਸਾਰੇ ਕਿਸਾਨ ਇਸ ਉਤ ਇਸ ਕਿੱਤੇ ਉੱਤੇ ਹੀ ਨਿਰਭਰ ਸਨ